ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਓਕੇ ਕੋਈ ਮੈਨੂੰ ਨਾਮ ਵਗੈਰਾ ਦੱਸ ਸਕਦੇ ਓਂ ਓਕੇ

ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਸਰ ਤੁਸੀਂ ਬਹੁਤ ਅੱਛਾ ਕੰਮ ਕੀਤਾ ਅਤੇ ਬਹੁਤ ਵਧੀਆ ਜੀ ਅਤੇ ਤੁਹਾਨੂੰ ਕੋਈ ਗੱਲ ਨਹੀਂ ਮੇਰੇ ਕੋਲ ਨਾ ਪੇਰੈਂਟਸ ਆਏ ਨੇ ਅਤੇ ਤੁਸੀਂ ਬਹੁਤ ਅੱਛਾ ਕੰਮ ਕੀਤਾ ਓਕੇ ਜੀ ਓਕੇ ਥੈਂਕ ਯੂ